ਹੈਲੋ ਰੇਲਵੇ ਸਟੇਸ਼ਨ ਤੋਂ ਬੋਲੀ ਜਾਂਦੇ ਤੁਸੀਂ ਮੈਂ ਨਾ ਦਿੱਲੀ ਤੋਂ ਆਈ ਹਾਂ ਅਤੇ ਫਿਰੋਜ਼ਪੁਰ ਮੈਂ ਕੀ ਕੀਤਾ ਅਤੇ ਹੁਣ ਨਾ ਮੈਂ ਫਾਜ਼ਿਲਕਾ ਦੀ ਗੱਡੀ ਕਿੱਥੇ ਕਿੱਥੇ ਜਾਂਦੀ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਦਾ ਅਤੇ ਟਾਈਮ ਮੈਨੂੰ ਦੱਸ ਮੈਂ ਤਾਂ ਘੁੰਮਣ ਵਾਸਤੇ ਆਈ ਹੋਈ ਹਾਂ ਮੈਂ ਪੂਰੇ ਪੰਜਾਬ ਅਤੇ ਪੂਰੇ ਭਾਰਤ ਦਾ ਨਾ ਘੁੰਮਣ ਆਈ ਹੋਈ ਹਾਂ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਮੈਨੂੰ ਜੇ ਹਰਿਦੁਆਰ ਵਾਲੀ ਗੱਡੀ ਦਾ ਦੱਸ ਦਿਓ ਮੈਨੂੰ ਫਿਰੋਜ਼ਪੁਰ ਵਾਲੀ ਦਾ ਵੀ ਦੱਸ ਦਿਓ ਗੰਗਾਨਗਰ ਵਾਲੀ ਅਤੇ ਪੋਰ ਦਾ ਵੀ ਸਾਰਿਆਂ ਦਾ ਦੱਸੋ ਤੁਸੀਂ ਮੈਨੂੰ ਅਛ ਚੰਗਾ ਅੱਛਾ ਅੱਛਾ ਫਿਰੋਜ਼ਪੁਰ ਵਾਲੀ ਅੱਛਾ ਇਹ ਬਠਿੰਡਾ ਵਗੈਰਾ ਜਾਂਦੀ ਇੱਥੋਂ ਮੈਂ ਤਾਂ ਪੂਰੇ ਕਿਹਾ ਤਾ ਹੈ ਘੁੰਮਣ ਵਾਸਤੇ ਆਈ ਹੋਈ ਹਾਂ ਮੈਂ ਤਾਂ ਦੇਖੋ ਠੀਕ ਆ ਓ ਅਤੇ ਹੋਰ ਵੀ ਮੈਨੂੰ ਟਾਈਮ ਵਗੈਰਾ ਦੱਸਣਾ ਹੋਵੇ ਤਾਂ ਦੱਸ ਦਿਓ ਕਿੱਥੇ ਕਿੱਥੇ ਹੋਰ ਜਾਂਦੀ ਹੈ

ਹਾਂਜੀ ਉਹ ਤਾਂ ਮੈਂ ਵੇਖ ਲਾਂਗੀ ਚਲੋ ਠੀਕ ਹੈ ਧੰਨਵਾਦ